ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਲਾ ਜਿਊਲਰਸ ਤੋਂ ਬੋਲਦੇ ਹੋ ਮੈਮ ਮੈਂ ਨਾ ਸੋਨੇ ਦਾ ਔਡਰ ਦੇਣਾ ਸੀ ਮੈਮ ਮੇਰੇ ਨਾ ਬੇਟੀ ਦਾ ਵਿਆਹ ਏ ਉਹਦੇ ਵਾਸਤੇ ਇੱਕ ਕਿੱਟੀ ਸੈੱਟ ਬਣਾਉਣਾ ਏ ਅਤੇ ਦੋ ਰਿੰਗਸ ਬਣਾਉਣੀਆਂ ਨੇ ਜਿਸ ਤਰ੍ਹਾਂ ਡੇਢ ਕੁ ਡੇਢ ਕੁ ਤੋਲੇ ਵਿੱਚ ਬਣ ਜੇ ਅਤੇ ਦੋ ਜੈਂਟਸ ਰਿੰਗ ਬਣਾਉਣੀਆਂ ਨੇ ਅੱਧੇ ਅੱਧੇ ਤੋਲੇ ਦੀ ਅਤੇ ਕੀ ਰੇਟ ਚੱਲਦਾ ਹੁਣ ਸੋਨੇ ਦਾ ਹਾਂਜੀ ਮੈਮ ਚੌਵੀ ਚੋਵੀ ਕੈਰੇਟ ਦਾ ਬਣਾਵਾਂਗੇ ਅਤੇ ਤੁਸੀਂ ਨਾ ਇੱਕ ਕਿੱਟੀ ਸੈੱਟ ਦੋ ਰਿੰਗਸ ਅਤੇ ਦੋ ਦੋ ਜੈਂਟਸ ਰਿੰਗ ਅਤੇ ਇੱਕ ਜੈਂਟਸ ਕੜਾ ਅਤੇ ਮੈਮ ਤੁਸੀਂ ਬਣਾ ਦਿਓ ਅਤੇ ਤਿਆਰ ਮਤਲਬ ਤਿਆਰ ਕਰਵਾ ਦਿਓ ਜੋ ਜੋ ਤੁਹਾਡੀ ਪੇਮੈਂਟ ਹੋਏਗੀ ਤੁਸੀਂ ਦੱਸ ਦਿਓ ਅਤੇ ਅਸੀਂ ਪਰਸੋਂ ਅਸੀਂ ਪਰਸੋਂ ਨੂੰ ਆਵਾਂਗੇ ਹਾਂਜੀ ਅਤੇ ਇੱਕ ਨਾ ਚਾਂਦੀ ਦੀਆਂ ਝਾਂਜਰਾਂ ਬਣਵਾਉਣੀਆਂ ਨੇ ਹਾਂਜੀ ਕੁੜੀ ਵਾਸਤੇ ਅਤੇ ਇੱਕ ਜਿਹੜੇ ਪੈਰਾਂ ਨੂੰ ਵਿਛੂਏ ਨਹੀਂ ਪਾਈਦੇ ਦੋ ਦੋ ਜੋੜੀ ਉਹ ਕਰ ਦਿਓ ਹਾਂਜੀ ਅਤੇ ਇੱਕ ਨਾ ਸੱਸ ਵਾਸਤੇ ਟੋ ਸੱਸ ਵਾਸਤੇ ਨਹੀਂ ਹਾਂਜੀ ਇੱਕ ਸੱਸ ਵਾਸਤੇ ਟੋਪਸ ਬਣਾ ਦਿਓ ਅੱਧੇ ਤੋਲੇ ਦੇ ਕਰ ਲਿਉ ਨੋਟ ਕਰ ਲਿਓ ਹਾਂਜੀ ਹਾਂ ਇੱਕ ਸਹੁਰੇ ਵਾਸਤੇ ਰਿੰਗ ਹੈ ਉਹ ਵੀ ਅੱਧੇ ਕੁ ਤੋਲੇ ਦੀ ਹੋ ਜੇ ਹਾਂਜੀ ਅਤੇ ਇੱਕ ਉਹਦੇ ਇੱਕ ਹੋਰ ਇਸ ਤੋਂ ਇਲਾਵਾ ਨਾ ਇੱਕ ਬਣਾਉਣੀ ਹੈ ਜਿਸ ਤਰ੍ਹਾਂ ਕਿ ਦੇਣ ਵਾ ਦੇਣ ਲੈਣ ਵਾਸਤੇ ਦੋ ਕੁ ਗਰਾਮ ਦੀ ਸ਼ਾਪ ਹੋ ਜੇ ਹਾਂਜੀ ਅਤੇ ਤੁਸੀਂ ਨਾ ਟੋਟਲ ਕਰਕੇ ਸਾਰਾ ਹਿਸਾਬ ਅਤੇ ਬਣਵਾ ਦਿਓ ਅਸੀਂ ਪਰਸੋਂ ਨੂੰ ਨਾ ਚੈੱਕ ਕਰਨ ਆਵਾਂਗੇ ਹਾਂਜੀ ਠੀਕ ਹੈ ਜੀ ਠੀਕ ਹੈ ਓਕੇ ਮੈਮ ਓਕੇ ਓਕੇ